ਜਦੋਂ ਵੀ ਮੈਂ ਕਿਤੇ ਬਾਹਰ ਜਾਂਦਾ ਹਾਂ ਵੈਸੇ ਮੈਂ ਇਹ ਚੀਜ ਦਾ ਬਹੁਤ ਹੀ ਗੌਰ ਤਰੀਕੇ ਦੇ ਨਾਲ਼ ਧਿਆਨ ਰੱਖਦਾ ਹਾਂ ਕਿ ਪੇੜ ਪੌਦਿਆਂ ਨੂੰ ਕੋਈ ਵੀ ਕਿਸੇ ਪ੍ਰਕਾਰ ਦੀ ਸਮੱਸਿਆ ਨਾ ਹੋਵੇ ਮੈਂ ਮਾਲੀ ਨੂੰ ਗਾਈਡ ਕਰਕੇ ਜਾਂਦਾ ਹਾਂ ਅਤੇ ਮਾਲੀ ਨੂੰ ਇਸ ਪ੍ਰਕਾਰ ਦੱਸ ਕੇ ਜਾਂਦਾ ਹਾਂ ਕਿ ਉਹ ਮੇਰੇ ਜਾਣ ਤੋਂ ਬਾਅਦ ਪੇੜ ਪੌਦਿਆਂ ਦਾ ਸਪੈਸ਼ਲ ਹੀ ਜ਼ਿਆਦਾਤਰ ਧਿਆਨ ਰੱਖਿਆ ਜਾਵੇ ਜਾਵੇ ਫੁੱਲਾਂ ਦਾ ਸਪੈਸ਼ਲ ਧਿਆਨ ਰੱਖਿਆ ਜਾਵੇ ਅਤੇ ਉਹਨੂੰ ਮੈਂ ਖਾਦ ਹੋਰ ਕੀਟਨਾਸ਼ਕ ਕੋਈ ਵੀ ਦਵਾਈ ਇਹੋ ਜਿਹੀ ਦੱਸ ਕੇ ਜਾਂਦਾ ਹਾਂ ਜਿਹੜੀ ਟਾਈਮ ਟੂ ਟਾਈਮ ਪਾਉਣੀ ਹੋਵੇ ਅਤੇ ਬਾਕੀ ਵੈਸੇ ਤਾਂ ਮੈਂ ਆਪ ਜਿਸ ਟਾਈਮ ਘਰ ਹੁੰਦਾ ਹਾਂ ਅਤੇ ਆਪ ਮਾਲੀ ਦੇ ਨਾਲ਼ ਹੋ ਕੇ ਵਧੀਆ ਤਰੀਕੇ ਦੇ ਨਾਲ਼ ਪੇੜ ਪੌਦਿਆਂ ਦਾ ਬੂਟਿਆਂ ਦਾ ਪੌਦਿਆਂ ਦਾ ਵਧੀਆ ਤਰੀਕੇ ਨਾਲ਼ ਧਿਆਨ ਰੱਖਦਾ ਹਾਂ